ਭੰਗੜਾ ਐਰੋਬਿਕਸ ਇੱਕ ਬਹੁਤ ਹੀ ਜੋਸ਼ ਉਤਸ਼ਾਹ ਅਤੇ ਊਰਜਾ ਨਾਲ ਕਰਨ ਵਾਲੀ ਐਕਸਰਸਾਈਜ ਹੈ ਮੈਂ ਇਸ ਬਾਰੇ ਬਚਪਨ ਤੋਂ ਹੀ ਸੁਣਦੀ ਆ ਰਹੀ ਹਾਂ ਭੰਗੜਾ ਦਾ ਸੰਗੀਤ ਬਹੁਤ ਹੀ ਜੀਵੰਤ ਹੈ ਅਤੇ ਇਸ ਦਾ ਸਰੋਤਿਆ 'ਤੇ ਮਾੜਾ ਅਸਰ ਵੀ ਪਿਆ ਹੈ ਲੋਕ ਇੰਨੇ ਜੋਸ਼ ਵਿੱਚ ਕਰ ਜਾਂਦੇ ਹਨ ਕਿ ਕਦੇ ਕਦੇ ਇਸ ਦੇ ਅਸਰ ਬਾਰੇ ਭੁੱਲ ਜਾਂਦੇ ਹਨ ਭੰਗੜਾ ਸਾਡੇ ਸਰੀਰ ਨੂੰ ਇੰਨਾ ਤਰੋ ਤਾਜ਼ਾ ਰੱਖਦਾ ਹੈ ਅਤੇ ਸਾਡੇ ਮਨ ਨੂੰ ਵੀ ਇੰਨਾ ਨੂੰ ਤਰੋ ਤਾਜ਼ਾ ਰੱਖਦਾ ਹੈ ਸੰਗੀਤ ਦੀ ਭਾਵਨਾ ਦੇ ਖੁੱਲ੍ਹੇ ਦਿਲ ਅਤੇ ਅਨਿਸ਼ਚਿਤ ਵਿਆਹ ਨੂੰ ਬਾਹਰ ਕੱਢਿਆ ਜਾਂਦਾ ਹੈ ਭੰਗੜਾ ਐਰੋਬਿਕਸ ਨਾਲ ਭੰਗੜਾ ਐਰੋਬਿਕਸ ਪੰਜਾਬ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਇਹ ਘੱਟੋ ਘੱਟ ਪੰਜ ਸੌ ਸਾਲ ਤੱਕ ਕੀਤੀ ਜਾ ਸਕਦੀ ਹੈ ਹਾਲਾਂਕਿ ਇਹ ਬਹੁਤ ਪਹਿਲਾਂ ਤੋਂ ਮੌਜੂਦ ਹੋ ਸਕਦੀ ਹੈ ਭੰਗੜਾ ਦੀਆ ਬਨੂਆ ਦੀਆਂ ਅੰਦੋਲਨਾਂ ਖੇਤੀਬਾੜੀ ਦੀਆਂ ਗਿਤੀਬਾਦੀਆਂ ਨਾਲ ਸੰਬੰਧਿਤ ਹੁੰਦੀਆਂ ਹਨ ਜਿਵੇਂ ਕਿ ਹੱਲਣਾ ਬਿਜਾਈ ਵਾਢੀ ਅਤੇ ਆਮ ਤੌਰ 'ਤੇ ਕਟਾਈ ਦੀ ਵਾਢੀ ਦਾ ਜਸ਼ਨ ਮਨਾਉਣ ਲਈ ਕੀਤਾ ਜਾਂਦਾ ਹੈ ਇਸ ਲਈ ਭੰਗੜੇ ਨੂੰ ਐਰੋਬਿਕਸ ਨਾਲ ਮਿਲਾ ਕੇ ਸਰੀਰ ਲਈ ਤਾਂ ਕਿ ਸਾਡਾ ਸਰੀਰ ਨਿਰਵੈਰ ਨਿਰਯੋਗ ਰਹੇ ਇਸ ਲਈ ਇਹ ਕਾਫੀ ਹੁਣ ਕਾਫੀ ਲੋਕਾਂ ਵਿੱਚ ਜਾਣਿਆ ਜਾਂਦਾ ਹੈ